ਮੇਰਾ ਜਿਹੜਾ ਈ ਸੇਵਾ ਨਾਲ ਅਨੁਭਵ ਸੀਗਾ ਉਹ ਬਹੁਤ ਵਧੀਆ ਰਿਹਾ ਮੈਂ ਆਧਾਰ ਕਾਰਡ ਦੇ ਵਿੱਚ ਅਪਡੇਸ਼ਨ ਕਰਵਾਉਣੀ ਸੀ ਅਤੇ ਇੱਥੇ ਮੈਂ ਕਿਸੇ ਸਾਰੇ ਕੈਫੇ ਤੋਂ ਪਤਾ ਕੀਤਾ ਸੀਗਾ ਸਾਰੇ ਬਹੁਤ ਜ਼ਿਆਦਾ ਪੈਸੇ ਮੰਗਦੇ ਸੀ ਅਤੇ ਜਿਹੜੀ ਫੀਸ ਸੀ ਫੀਸ ਤੋਂ ਵੀ ਜ਼ਿਆਦਾ ਪੈਸੇ ਮੰਗਦੇ ਸੀ ਉਰੇ ਸਾਰੇ ਲੋਕ ਅਤੇ ਮੇਰੀ ਫਰੈਂਡ ਨੇ ਮੈਨੂੰ ਸਜੈਸਟ ਕੀਤਾ ਕਿ ਤੁਸੀਂ ਉੱਥੇ ਸੇਵਾ ਕੇਂਦਰ ਜਾਓ ਅਤੇ ਉੱਥੇ ਜਾ ਕੇ ਅਪਲਾਈ ਕਰੋ ਅਪਲਾਈ ਕਰਕੇ ਉੱਥੇ ਕੋਈ ਇੱਦਾਂ ਹੋਵੇਗੀ ਨਹੀਂ ਫੀਸ ਵਗੈਰਾ ਨਹੀਂ ਹੋਵੇਗੀ ਫਰੀ 'ਚ ਤੁਹਾਡਾ ਕੰਮ ਹੋ ਜਾਵੇਗਾ ਬਸ ਜਿਹੜੇ ਵੀ ਪੰਜਾਹ ਕ ਰੁਪਈਏ ਲੱਗਣੇ ਐ ਜਿਹੜੇ ਗਵਰਮੈਂਟ ਫੀਸ ਆ ਉਹ ਹੀ ਲੱਗਣੀ ਐ ਬਸ ਅਤੇ ਉਹ ਮੇਰਾ ਕੰਮ ਫਟਾਫਟ ਹੋ ਗਿਆ ਚੌਵੀ ਘੰਟੇ ਦੇ ਅੰਦਰ ਅੰਦਰ ਆਧਾਰ ਕਾਰਡ 'ਚ ਮੇਰੇ ਅਪਡੇਸ਼ਨ ਹੋ ਗਈਆਂ ਸੀ ਇਹਤੋਂ ਬਾਅਦ ਮੈਂ ਲਾਈਸੈਂਸ ਲਈ ਅਪਲਾਈ ਕਰਨਾ ਸੀਗਾ ਲਾਈਸੈਂਸ ਲਈ ਅਪਲਾਈ ਜੇ ਅਸੀਂ ਬਾਹਰ ਲੋ ਕੈਫੇ ਤੋਂ ਕਰਵਾਉਂਦੇ ਸੀ ਤਾਂ ਉਹ ਤਿੰਨ ਤਿੰਨ ਚਾਰ ਚਾਰ ਹਜ਼ਾਰ ਰੁਪਈਆ ਮੰਗਦੇ ਸੀ ਜਦੋਂ ਮੈਂ ਖੁਦ ਆਨਲਾਈਨ ਜਾ ਕੇ ਲਰਨਿੰਗ ਲਾਈਸੈਂਸ ਲਈ ਅਪਲਾਈ ਕੀਤਾ ਸੀ ਤਾਂ ਉੱਥੇ ਸਿਰਫ਼ ਪੰਜ ਸੌ ਰੁਪਈਆ ਮੇਰੀ ਫੀਸ ਲੱਗੀ ਸੀ ਈ ਸੇਵਾ ਦੀ ਵੈਬਸਾਈਟ 'ਤੇ ਜਦੋਂ ਆਪਾਂ ਗਏ ਤਾਂ ਉੱਥੇ ਸਿਰਫ਼ ਪੰਜ ਸੌ ਰੁਪਈਆ ਮੇਰੀ ਫੀਸ ਲੱਗੀ ਅਤੇ